ਕੀ ਰਸੌਈ ਬਣਾਉਣ ਤ ਖਾਣਾ ਬਣਾਉਣ ਲਈ ਪ ਪ੍ਰਾਂਤ ਪ੍ਰਾਂਤ ਚਾਹੀਦੀ ਹੈ ਆਟਾ ਛਾਣਨੀ ਤਵਾ ਚਾਕੂ ਹੋਰ ਚਕਲਾ ਵੇਲਣਾ ਚਕਲਾ ਵੇਲਣਾ ਚਾਹੀਦਾ ਕੜਾਹੀ ਗੈਸ ਸਿਲਿੰਡਰ

ਲੈਟਰ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਅਤੇ ਨਾਲ ਕੜਾਹੀ ਖੁਰਚਣਾ ਕੜਛੀ ਇਹ ਚਾਹੀਦੀਆਂ ਨੇ